ਮੈਂ ਫੋਟੋਗ੍ਰਾਫੀ ਦਾ ਸ਼ੌਂਕ ਮੈਨੂੰ ਬਹੁਤ ਪਹਿਲਾਂ ਤੋਂ ਸੀ ਪਰ ਮੈਂ ਇਸਦੀ ਕਿਸੇ ਤੋਂ ਕੋਚਿੰਗ ਨਹੀਂ ਲਈ ਮੈਂ ਯੂਟਿਊਬ ਔਰ ਇੰ ਯੂਟਿਊਬ 'ਤੇ ਬਹੁਤ ਜ਼ਿਆਦਾ ਚੈਨਲ ਸਬਸਕ੍ਰਾਈਬ ਕੀਤੇ ਆ ਅਤੇ ਇੰਸਟਾਗ੍ਰਾਮ 'ਤੇ ਮੈਂ ਬਹੁਤ ਜਾਣਿਆਂ ਨੂੰ ਫੋਲੋ ਕੀਤਾ ਹੈ ਬਟ ਜੇ ਦੇਖਿਆ ਜਾਵੇ ਤਾਂ ਮੈਨੂੰ ਅੰਮ੍ਰਿਤ ਰਾਮਗੜੀਆ ਦੀ ਮੀਨਿੰਗ ਕਿ ਜੋ ਫੋਟੋਸ ਐਡਿਟ ਕਰਦੇ ਨੇ ਜਾਂ ਫੋਟੋਸ ਕਲਿੱਕ ਕਰਦੇ ਆ ਵੀਡੀਓਸ ਵਗੈਰਾ ਮੈਨੂੰ ਉਹਨਾਂ ਦੀ ਐਡਿਟਿੰਗ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਉਹਨਾਂ ਅਤੇ ਉਹਨਾਂ ਦੀ ਵੀਡੀਓਸ ਦੇਖ ਕੇ ਐਡੀਟਿੰਗ ਕਰਨ ਦੀ ਉਹਨਾਂ ਦੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਵਰਗੀ ਮੇਰੇ ਕੋਲ ਉਹ ਕੋਪੀ ਹੋਵੇ ਪਰ ਸੇਮ ਤਾਂ ਨਹੀਂ ਹੁੰਦੀ ਚਲੋ ਫਿਰ ਵੀ ਹੋ ਜਾਂਦੀ ਐਡੀਟਿੰਗ ਵਧੀਆ ਉਹਨਾਂ ਨਾਲ ਦੀ ਪਰ ਮੈਂ ਇਸਦੀ ਕੋਚਿੰਗ ਨਹੀਂ ਲਈ ਉਹਨਾਂ ਤੋਂ ਹੀ ਮਤਲਬ ਕਿ ਉਹਨਾਂ ਦੀ ਵੀਡੀਓਸ ਦੇਖਦੀ ਹਾਂ ਤਾਂ ਜੋ ਕਿ ਮੈਂ ਵੀ ਫੋਟੋਗ੍ਰਾਫੀ ਦਾ ਜਿਹੜਾ ਮੇਰਾ ਹੁਨਰ ਹੈ ਮੈਂ ਇਹਨੂੰ ਹੋਰ ਅੱਗੇ ਲੈ ਕੇ ਜਾ ਸਕਾਂ ਇਹਨੂੰ ਮੈਂ ਆਪਣਾ ਪ੍ਰੋਫੈਸ਼ਨ ਬਣਾ ਸਕਾਂ ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਬਾਕੀ ਨੂੰ ਵੀ ਜੇ ਕਿਸੇ ਨੇ ਵੀ ਇਹ ਕਰਨੀ ਫੋਟੋਗ੍ਰਾਫੀ ਕਰਨੀ ਹੈ ਤਾਂ ਯੂਟਿਊਬ 'ਤੇ ਨੋਰਮਲੀ ਬਹੁਤ ਜ਼ਿਆਦਾ ਚੈਨਲ ਹੁੰਦੇ ਹੈ ਪਰ ਜੇ ਹੋਰ ਵੀ ਬਹੁਤ ਨੇ ਉਹਨਾਂ ਦੀ ਵੀ ਫੋਟੋਗ੍ਰਾਫੀ ਬਹੁਤ ਅੱਛੀਆਂ ਹੁੰਦੀਆਂ ਉਹ ਵੀ ਬਹੁਤ ਵਧੀਆ ਮੀਨਿੰਗ ਕਿ ਫੋਟੋਸ ਕਲਿੱਕ ਕਰਕੇ ਐਡਿਟ ਕਰਕੇ ਦਿਖਾਉਂਦੇ ਨੇ ਪਰ ਕਈ ਵਾਰੀ ਉਹਨਾਂ ਦੀ ਸਮਝ ਨਹੀਂ ਆਉਂਦੀ ਹੈ ਬਾਕੀ ਬਹੁਤ ਜ਼ਿਆਦਾ ਹੋਰ ਵੀ ਹੈ ਜਿਵੇਂ ਕਿ ਇੰਦਰ ਰਾਮਗੜੀਆ ਹੋ ਗਿਆ ਦੋ ਤਿੰਨ ਹੀ ਹੈ ਜ਼ਿਆਦਾ ਕਰਕੇ ਮੈਂ ਇਹਨਾਂ ਦੀ ਓ ਦੇਖਦੀ ਆ ਰਾਮਗੜ ਅੰਮ੍ਰਿਤ ਰਾਮਗੜੀਆ ਔਰ ਇੰਦਰ ਰਾਮਗੜੀਆ ਦੇ ਵੀਡੀਓਸ ਬਹੁਤ ਜ਼ਿਆਦਾ ਵਧੀਆ ਹੁੰਦੀਆਂ